ਮੈਂ ਸਵਿਗੀ ਫੂ ਵਰਗੀ ਫੂਡ ਡਿਲੀਵਰੀ ਤੋਂ ਇੱਕ ਵਾਰ ਵਰਤੋਂ ਕੀਤੀ ਆ ਔਰ ਮੈਨੂੰ ਉਹਨਾਂ ਦਾ ਕੰਮ ਕਾਫੀ ਹੀ ਸੁਵਿਧਾਜਨਕ ਲੱਗਾ ਕਿਉਂਕਿ ਮੈਨੂੰ ਯਾਦ ਹੈ ਕਿ ਮੈਂ ਇੱਕ ਸਾਲ ਪਹਿਲਾਂ ਮੇਰੇ ਬੇਟੇ ਦੇ ਬਾਡੇ 'ਤੇ ਫੂਡ ਔਡਰ ਕੀਤਾ ਸੀ ਨਾਲ ਦੇ ਨਾਲ ਮੈਂ ਕੇਕ ਔਡਰ ਕੀਤਾ ਸੀ ਸਾਡੇ ਕੋਲ ਸਮਾਂ ਘੱਟ ਸੀ ਔਰ ਉਸ ਉਹਦੇ ਅਕੋਡਿੰਗ ਅਸੀਂ ਖਾਣ ਪੀਣ ਦਾ ਸਮਾਨ ਬਾਹਰੋਂ ਹੀ ਔਡਰ ਕਰ ਲਿਆ ਸੀਗਾ ਔਰ ਮੈਨੂੰ ਜੋ ਚੀਜ਼ਾਂ ਘਰ ਬਣਾਉਣੀਆਂ ਪੈਣੀਆਂ ਸੀ ਜਾਂ ਜਾਂ ਫਿਰ ਮੈਨੂੰ ਜੋ ਸਮਾਨ ਦਾ ਮਟੀਰੀਅਲ ਆਈਟਮ ਇਕੱਠੀਆਂ ਕਰਨੀਆਂ ਪੈਣੀਆਂ ਸੀ ਉਹ ਮੈਂ ਔਡਰ ਕੀਤਾ ਔਰ ਸੀਵੀ ਸਵਿਗੀ ਨੇ ਮੈਨੂੰ ਬਹੁਤ ਹੀ ਘੱਟ ਟਾਇਮ ਦੇ ਵਿੱਚ ਮੇਰਾ ਸਾਰਾ ਦਾ ਸਾਰਾ ਕੇਕ ਫੂਡ ਆਈਟਮਸ ਸਨੈਕਸ ਵਗੈਰਾ ਮੈਨੂੰ ਟਾਇਮ 'ਤੇ ਪਹੁੰਚਾ ਦਿੱਤਾ ਔਰ ਮੈਂ ਬਹੁਤ ਖੁਸ਼ ਹੋਈ ਔਰ ਮੈਨੂੰ ਬਹੁਤ ਹੀ ਵਧੀਆ ਲੱਗਾ